ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਉੱਚੀਆਂ ਚੜਾਈਆਂ ਚੜਦੇ ਹੋਏ ਆਕਸੀਜਨ ਦੀ ਕਮੀ ਵੀ ਮਹਿਸੂਸ ਹੁੰਦੀ ਹੈ ਬਟ ਪਰ ਇਹ ਚੀਜ਼ ਮੇਰੇ ਨਾਲ ਹਜੇ ਤੱਕ ਤਾਂ ਨਹੀਂ ਹੋਈ ਪਰ ਜੇ ਕਦੇ ਹੁੰਦੀ ਵੀ ਹੈ ਤਾਂ ਇਸ ਲਈ ਹਮੇਸ਼ਾ ਆਪਣੇ ਨਾਲ ਉੱਚੀਆਂ ਚੜਾਈਆਂ ਚੜਨ ਲੱਗੇ ਆਕਸੀਜਨ ਸਿਲੰਡਰ ਹਮੇਸ਼ਾ ਆਪਣੇ ਨਾਲ ਰੱਖੋ ਇਸ ਲਈ ਖਾਸ ਕਰਕੇ ਦਵਾਈ ਵੀ ਆਉਂਦੀ ਹੈ ਜਿਸ ਨਾਲ ਆਕਸੀਜਨ ਲੈਵਲ ਤੁਹਾਡੇ ਸਰੀਰ ਵਿੱਚ ਹਮੇਸ਼ਾ ਬਰਕਰਾਰ ਰਹਿੰਦਾ ਹੈ ਅਤੇ ਉਹ ਤੁਹਾਡੇ ਉਹ ਤੁਹਾਡੇ ਕਈ ਚੀਜ਼ਾਂ ਤੋਂ ਬਚਾਉਂਦਾ ਹੈ ਜਿਵੇਂ ਕਿ ਸਿਰ ਦੁੱਖਣਾ ਚੱਕਰ ਆਉਣੇ ਅਤੇ ਇਹ ਸਭ ਦਵਾਈਆਂ ਇਹ ਓਕਸੀਜਨ ਸਿਲੰਡਰ ਹਮੇਸ਼ਾ ਆਪਣੇ ਨਾਲ ਉੱਚੀਆਂ ਚੜਾਈਆਂ ਵੇਲੇ ਨਾਲ ਰੱਖੋ ਅਤੇ ਕਦੇ ਵੀ ਡਰੋ ਨਾ ਅਤੇ ਹਮੇਸ਼ਾ ਉੱਚੀ ਚੜਾਈ ਚੜਨ ਵੇਲੇ ਆਪਣੇ ਕਦਮ ਜਿਹੜੇ ਆ ਉਹ ਛੋਟੇ ਰੱਖੋ ਅਤੇ ਬਸ ਤੁਸੀਂ ਚੜਦੇ ਜਾਓ ਅਤੇ ਤੁਹਾਨੂੰ ਕੋਈ ਤਕਲੀਫ ਨਹੀਂ ਆਏਗੀ ਪਰ ਜੇ ਪਰ ਹਮੇਸ਼ਾ ਤਕਲੀਫ ਨਾ ਆਵੇ ਰੱਬ ਕਰੇ ਬਟ ਹਮੇਸ਼ਾ ਉਸ ਤਕਲੀਫ ਲਈ ਤਿਆਰ ਰਹੋ ਅਤੇ ਉਸ ਦੇ ਲਈ ਜ਼ਰੂਰਤਮੰਦ ਚੀਜ਼ਾਂ ਹਮੇਸ਼ਾ ਨਾਲ ਰੱਖੋ